ਭੰਗੜਾ ਸਰੀਰ ਨੂੰ ਸਫੁਰਤੀ ਦੇਣ ਵਾਲਾ ਇੱਕ ਬਹੁਤ ਵਧੀਆ ਲੋਕ ਨਾਚ ਹੈ ਜਿਹੜਾ ਕਿ ਸੰਗੀਤ ਦੀਆਂ ਧੁਨਾਂ ਦੇ ਉੱਤੇ ਨੱਚਿਆ ਜਾਂਦਾ ਹੈ ਭੰਗੜਾ ਸਾਡਾ ਪੁਰਾਤਨ ਲੋਕ ਨਾਚ ਹੈ ਅਤੇ ਪੰਜਾਬ ਦੇ ਲੋਕ ਇਸ ਨੂੰ ਬਹੁਤ ਹੀ ਜੋਸ਼ ਅਤੇ ਉਲਾਸ ਨਾਲ ਨੱਚਦੇ ਹਨ ਇਹ ਤਿਉਹਾਰਾਂ ਵੇਲੇ ਵਿਆਹ ਸ਼ਾਦੀਆਂ ਵੇਲੇ ਪਾਇਆ ਜਾਂਦਾ ਹੈ ਮੁੱਖ ਤੌਰ 'ਤੇ ਇਹ ਕਣਕਾਂ ਦੀ ਵਾਢੀ ਵੇਲੇ ਮਤਲਬ ਕਿ ਵਿਸਾਖੀ ਵੇਲੇ ਪਾਇਆ ਜਾਂਦਾ ਹੈ ਭੰਗੜੇ ਨਾਲ ਸਾਡੇ ਸਰੀਰ ਨੂੰ ਸਫੁਰਤੀ ਮਿਲਦੀ ਹੈ ਅਤੇ ਇਸ ਨਾਚ ਨਾਲ ਸਾਡਾ ਸਰੀਰ ਸੰਤੁਲਿਤ ਹੁੰਦਾ ਹੈ ਇਹ ਇੱਕ ਤਰ੍ਹਾਂ ਦੀ ਸਰੀਰਕ ਐਕਸਰਸਾਈਜ਼ ਹੈ ਇਸ ਦੇ ਨਾਲ ਸਾਡੀਆਂ ਬਾਵਾਂ ਲੱਕ ਲੱਤਾਂ ਦੀਆਂ ਮਸਲਸ ਜਿਹੜੀਆਂ ਨੇ ਉਹ ਚੁਸਤ ਦਰੁਸਤ ਹੁੰਦੀਆਂ ਹਨ